ਮੈਂ ਫਲਿਪਕਾਰਟ ਤੋਂ ਔਨਲਾਈਨ ਔਡਰ ਬੁੱਕ ਕੀਤਾ ਸੀਗਾ ਤਾਂ ਫਸਟ ਪ੍ਰੋਡਕਟ ਮੇਰਾ ਜਿਹੜਾ ਆਇਆ ਬਹੁਤ ਹੀ ਵਧੀਆ ਸੀਗਾ ਫਲਾਵਰ ਪੋਟ ਮੈਂ ਔਡਰ ਕੀਤੇ ਸੀਗੇ ਉਹਨਾਂ ਦੇ ਪੂਰੇ ਅੱਛੇ ਕਲਰ ਸੀਗੇ ਪੂਰਾ ਅੱਛਾ ਡਿਜ਼ਾਇਨ ਸੀ ਉਹਦਾ ਫਿਰ ਉਸ ਤੋਂ ਬਾਅਦ ਫਿਰ ਮੈਂ ਸੈਕਿੰਡ ਪ੍ਰੋਡਕਟ ਔਡਰ ਕੀਤਾ ਐਵੇਜ਼ੋਨ ਤੋਂ ਐਵੇਂਜ਼ੋਨ ਤੋਂ ਔਡਰ ਕੀਤਾ ਅਤੇ ਫਿਰ ਮੈਨੂੰ ਬੜੀ ਪਰੇਸ਼ਾਨੀ ਆਈ ਮੇਰਾ ਬੋਕਸ ਬਿਲਕੁਲ ਹੀ ਖਾਲੀ ਮਿਲਿਆ ਮੈਨੂੰ ਜੋ ਮੈਂ ਔਡਰ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਮੈਂ ਜਦੋਂ ਉਹਨਾਂ ਨਾਲ ਕਾਲ ਸੈਂਟਰ 'ਤੇ ਗੱਲ ਕੀਤੀ ਤਾਂ ਉਹ ਕਹਿੰਦੇ ਵੀ ਸਰ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਪ੍ਰੋਡਕਟ ਹੈ ਅਸੀਂ ਤੁਹਾਨੂੰ ਦੁਬਾਰਾ ਰਿਪਲੇਸ ਕਰਵਾ ਕੇ ਵੀ ਨਵਾਂ ਅਸੀਂ ਤੁਹਾਨੂੰ ਭੇਜਦੇ ਹਾਂ ਇਹ ਕਹਿ ਕੇ ਉਹਨਾਂ ਨੇ ਮੇਰਾ ਫੋਨ ਕੱਟ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਇੱਕ ਮਹੀਨੇ ਤੱਕ ਉਹਨਾਂ ਦਾ ਫੋਲੋ ਅਪ ਲੈਂਦਾ ਰਿਹਾ ਫੋਲੋ ਅਪ ਲੈਂਦਾ ਰਿਹਾ ਤਾਂ ਫਿਰ ਮੇਰਾ ਜਿਹੜਾ ਸੈਕਿੰਡ ਪ੍ਰੋਡਕਟ ਸੀਗਾ ਉਹ ਮੈਨੂੰ ਬਿਲਕੁਲ ਹੀ ਵਧੀਆ ਨਹੀਂ ਲੱਗਿਆ ਜਿਹੜਾ ਉਹਨਾਂ ਨੇ ਭੇਜਿਆ ਅਤੇ ਬਸ ਇਹ ਮੇਰਾ ਬੈਡ ਐਕਸਪੀਰੀਅੰਸ ਗੰਦਾ ਐਕਸਪੀਰੀਅੰਸ ਰਿਹਾ ਕਿ ਜਿਹੜਾ ਮੈਂ ਔਡਰ ਕੀਤਾ ਸੀ ਸੈਕਿੰਡ ਟਾਈਮ ਉਹਦਾ ਮੈਨੂੰ ਬੜਾ ਹੀ ਨੈਗਟਿਵ ਰਿਵਿਊ ਮਿਲਿਆ ਅਤੇ ਮੈਂ ਉਹ ਅਪਡੇਟ ਵੀ ਕੀਤਾ ਉੱਥੇ